ਸਾਡੇ ਭਾਈਚਾਰੇ ਸੱਭਿਆਚਾਰ ਦੇ ਵਿੱਚ ਖੇਡਾਂ ਦਾ ਬਹੁਤ ਵੱਡੀ ਭੂਮਿਕਾ ਵਾ ਜਦੋਂ ਖਿਡਾਰੀ ਇਕੱਠੇ ਖੇਡਦੇ ਆ ਉਹਦੇ ਵਿੱਚ ਵੱਖੋ ਵੱਖ ਜਾਤਾਂ ਦੇ ਵੱਖੋ ਵੱਖ ਧਰਮਾਂ ਦੇ ਲੋਕ ਆਣਗੇ ਖਿਡਾਰੀ ਦੇ ਰੂਪ ਦੇ ਵਿੱਚ ਜਦੋਂ ਖੇਡਦੇ ਮੈਚ ਦੇ ਉਦੋਂ ਉਹਨਾਂ ਦੇ ਵਿੱਚ ਪ੍ਰੇਮ ਪਿਆਰ ਵੱਧਦਾ ਇਸ ਤਰੀਕੇ ਨਾਲ ਜਦੋਂ ਜਿਹੜੇ ਦਰਸ਼ਕ ਆਉਂਦੇ ਹੈ ਵੇਖਣ ਮੈਚ ਉਹਨਾਂ ਦੇ ਵਿੱਚ ਵੀ ਜਦੋਂ ਅਲੱਗ ਅਲੱਗ ਧਰਮਾਂ ਦੇ ਲੋਗ ਅਲੱਗ ਅਲੱਗ ਜਾਤਾਂ ਦੇ ਲੋਕ ਇਕੱਠੇ ਬੈਠ ਕੇ ਮੈਚ ਵੇਖਦੇ ਆ ਤਾਂ ਉਹਨਾਂ ਦਾ ਆਪਸ ਵਿੱਚ ਪ੍ਰੇਮ ਪਿਆਰ ਭਾਈਚਾਰਾ ਵੱਧਦਾ ਵਾ ਇਹਨਾਂ ਦੇ ਵਿੱਚ ਜਦੋਂ ਬੱਚੇ ਖੇਡਦੇ ਆ ਤਾਂ ਉਹਨਾਂ ਨੂੰ ਵੇਖਕੇ ਦੂਜੇ ਜਿਹੜੇ ਦਰਸ਼ਕ ਹੁੰਦੇ ਆ ਉਹਨਾਂ ਦਾ ਵੀ ਉਤਸ਼ਾਹ ਬਣਦਾ ਵਾ ਵੀ ਸਾਡਾ ਜਿਹੜੇ ਬੱਚੇ ਆ ਉਹ ਵੀ ਖੇਡਾਂ ਲਈ ਦੇ ਵਿੱਚ ਹੋਣ ਅਤੇ ਸਾਡੇ ਚੰਗੇ ਖਿਡਾਰੀ ਬਣਨ ਇਸ ਕਰਕੇ ਉਹਨਾਂ ਲਈ ਉਤਸ਼ਾਹ ਵੀ ਵੱਧਦਾ ਵਾ ਅਤੇ ਸੱਭਿਆਚਾਰਕ ਸਾਂਝ ਵੀ ਬਣ ਜਾਂਦੀ ਹੈ ਕੋਈ ਲੋਕ ਕਿਤਿਓ ਤੋਂ ਆਇਆ ਹੁੰਦਾ ਕੋਈ ਕਿਸੇ ਕਿਸੇ ਜਗ੍ਹਾ ਤੋਂ ਆਇਆ ਹੁੰਦਾ ਅਤੇ ਜਦੋਂ ਉਹ ਖੇਡਾਂ ਦੇ ਮੈਦਾਨ 'ਚ ਇਕੱਠੇ ਵੇਖਦੇ ਆ ਜਾਂ ਦਰਸ਼ਕ ਹੋਣ ਜਾਂ ਉਹ ਖਿਡਾਰੀ ਹੋਣ ਉਹਨਾਂ ਦੇ ਵਿੱਚ ਪ੍ਰੇਮ ਪਿਆਰ ਵੱਧਦਾ ਅਤੇ ਜਿਹੜੇ ਸੱਭਿਆਚਾਰ ਜਿਹੜਾ ਇੱਕ ਦੂਜੇ ਨਾਲ ਜਿਹੜਾ ਡਿਵੈਲਪਮੈਂਟ ਹੁੰਦੇ ਆ ਉਹਦੇ ਨਾਲ ਬਹੁਤ ਜ਼ਿਆਦਾ ਫ਼ਾਇਦਾ ਖੇਡਾਂ ਦੀ ਭੂਮਿਕਾ ਬਹੁਤ ਜ਼ਿਆਦਾ ਵੱਡੀ ਆ ਖੇਡਾਂ ਦੀ ਸਾਡੇ ਸੱਭਿਆਚਾਰ ਦੇ ਵਿੱਚ ਅਤੇ ਭਾਈਚਾਰੇ ਦੀ ਸਾਂਝ ਵਧਾਉਣ ਦੇ ਵਿੱਚ